ਹਾਂਜੀ ਦੋਸਤੋ ਮੈਂ ਤੁਹਾਨੂੰ ਅੱਜ ਆਪਣੀ ਗਾਇਕੀ ਦੇ ਅਨੁਭਵਾਂ ਬਾਰੇ ਦੱਸਣਾ ਚਾਹੁੰਦੀ ਹਾਂ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਮੈਂ ਗਾ ਸਕਦੀ ਹਾਂ ਇਸ ਬਾਰੇ ਮੈਨੂੰ ਪਤਾ ਚੱਲਿਆ ਜਦੋਂ ਮੈਂ ਨਾਈਨਥ ਕਲਾਸ ਵਿੱਚ ਹੋਈ ਤਾਂ ਜਦੋਂ ਸਭ ਤੋਂ ਪਹਿਲਾਂ ਸਾਡੇ ਘਰ ਦੇ ਵਿੱਚ ਇੱਕ ਟੇਪ ਰਿਕੋਰਡ ਆਇਆ ਤਾਂ ਉਸਦੇ ਵਿੱਚ ਜਿਹੜੇ ਅਸੀਂ ਮਤਲਬ ਗਾਣੇ ਵਜਾਏ ਤਾਂ ਉਹਨਾਂ ਨੂੰ ਮੈਂ ਹੂ ਬਹੂ ਉਸ ਤਰ੍ਹਾਂ ਦਾ ਹੀ ਮਤਲਬ ਗਾ ਸਕਦੀ ਸੀ ਮੈਂ ਉਹਨਾਂ ਨੂੰ ਸੁਣਿਆ ਤਾਂ ਮੈਂ ਉੱਦਾਂ ਹੀ ਸੇਮ ਟੂ ਸੇਮ ਨਾਲ ਉਹਨਾਂ ਨੂੰ ਗਾਇਆ ਤਾਂ ਫਿਰ ਮੈਨੂੰ ਪਤਾ ਚੱਲਿਆ ਕਿ ਮੈਂ ਜਿਹੜਾ ਹੈ ਉਹ ਅੱਛਾ ਗਾ ਸਕਦੀ ਹਾਂ ਤਾਂ ਫਿਰ ਮੈਂ ਆਪਣੇ ਸਕੂਲ ਦੇ ਵਿੱਚ ਵੀ ਇਸ ਤਰ੍ਹਾਂ ਹੀ ਜਦੋਂ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਗੁਣਗੁਣਾਉਂਦੀ ਸੀ ਤਾਂ ਉਹਨਾਂ ਮੇਰੇ ਦੋਸਤਾਂ ਨੂੰ ਵੀ ਪਤਾ ਚੱਲ ਗਿਆ ਕਿ ਮੈਂ ਅੱਛਾ ਗਾ ਸਕਦੀ ਹਾਂ ਤਾਂ ਉਹ ਅੱਗੇ ਹੌਲੀ ਹੌਲੀ ਚੱਲ ਕੇ ਫਿਰ ਉਹਨਾਂ ਨੇ ਸਾਡੇ ਟੀਚਰਜ਼ ਨੂੰ ਵੀ ਇਹ ਗੱਲ ਪਤਾ ਚੱਲ ਗਈ ਤਾਂ ਫਿਰ ਟੀਚਰਜ਼ ਨੇ ਵੀ ਮੇਰੇ ਤੋਂ ਗਾਣੇ ਸੁਣਨ ਦੀ ਇੱਛਾ ਪ੍ਰਗਟ ਕੀਤੀ ਕਲਾਸ ਦੇ ਵਿੱਚ ਜਦੋਂ ਵੀ ਫ਼ਰੀ ਪੀਰੀਅਡ ਹੁੰਦਾ ਤਾਂ ਉਹ ਕਹਿੰਦੇ ਸੀ ਕਿ ਗੁਰਜੀਤ ਗਾਣਾ ਸੁਣਾਏਗੀ ਤਾਂ ਫਿਰ ਮੈਂ ਜਦੋਂ ਉਹਨਾਂ ਨੂੰ ਗਾਣਾ ਸੁਣਾਉਂਦੀ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਤਾਰੀਫ਼ ਮਿਲਦੀ ਸੀ ਸੁਣਨ ਦੇ ਵਿੱਚ ਜਦੋ ਮੈਂ ਸੁਣਾਉਂਦੀ ਸੀ ਇਹ ਮੇਰੀ ਅਵਾਜ਼ ਜਿਹੜੀ ਹੈਗੀ ਆ ਮੈਨੂੰ ਹੌਲੀ ਹੌਲੀ ਮਹਿਸੂਸ ਹੋਇਆ ਕਿ ਬਹੁਤ ਹੀ ਰੱਬ ਦੀ ਮੇਰੇ 'ਤੇ ਕਿਰਪਾ ਕੀਤੀ ਆ ਔਰ ਮੈਨੂੰ ਬਹੁਤ ਹੀ ਅੱਛੀ ਅਵਾਜ਼ ਜਿਹੜੀ ਹੈਗੀ ਹੈ ਪ੍ਰਦਾਨ ਕੀਤੀ ਹੈ ਤਾਂ ਅੱਗੇ ਜਾ ਕੇ ਫਿਰ ਮੈਂ ਬਿਲਕੁਲ ਹੀ ਮਤਲਬ ਗਾਣੇ ਦਾ ਮੈਨੂੰ ਕੋਈ ਚਾਨਸ ਨਹੀਂ ਮਿਲਿਆ ਕੋਈ ਪਲੇਟਫੋਰਮ ਨਹੀਂ ਮਿਲਿਆ ਜਿਸਦੇ ਵਿੱਚ ਕਿ ਮੈਂ ਇਸਦੇ ਵਿੱਚ ਆਪਣਾ ਕੋਈ ਕਰੀਅਰ ਬਣਾ ਸਕਦੀ ਲੇਕਿਨ ਫਿਰ ਥੋੜ੍ਹੇ ਟਾਈਮ ਤੋਂ ਬਾਅਦ ਜਦੋਂ ਮੈਂ ਬੀ ਐਡ ਕੀਤੀ ਤਾਂ ਬੀ ਐਡ ਦੇ ਵਿੱਚ ਜਾ ਕੇ ਫਿਰ ਤੋਂ ਉੱਥੇ ਜਦੋਂ ਇਹ ਮਤਲਬ ਯੂਥ ਫੈਸਟੀਵਲ ਹੁੰਦੇ ਸੀ ਕੋਮਪੀਟੀਸ਼ਨ ਹੁੰਦੇ ਸੀ ਤਾਂ ਉਸਦੇ ਵਿੱਚ ਮੈਨੂੰ ਸਿਲੈਕਟ ਕੀਤਾ ਗਿਆ ਤਾਂ ਉਸਦੇ ਵਿੱਚ ਜਦੋਂ ਮੈਂ ਗਾਣਾ ਗਾਇਆ ਫਿਰ ਮੈਨੂੰ ਮਤਲਬ ਅਵੋਰਡ ਮਿਲਿਆ ਮੈਨੂੰ ਫਸਟ ਪਰਾਇਜ਼ ਮਿਲਿਆ ਇਸਦੇ ਨਾਲ ਫਿਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਔਰ ਮੈਨੂੰ ਬਹੁਤ ਸਾਰੇ ਮੇਰੇ ਦੋਸਤਾਂ ਨੇ ਵਧਾਈ ਵੀ ਦਿੱਤੀ ਜਿਸਦੇ ਨਾਲ ਕਿ ਮੈਨੂੰ ਬਹੁਤ ਜਿਆਦਾ ਅੱਛਾ ਲੱਗਿਆ ਇੱਕ ਵਾਰ ਇਹ ਵੀ ਹੋਇਆ ਸੀ ਕਿ ਜਦੋਂ ਮਤਲਬ ਮੇਰੀ ਗਾਣੇ ਦੀ ਅਵਾਜ਼ ਤਾਂ ਬਹੁਤ ਅੱਛੀ ਹੈ ਲੇਕਿਨ ਮੇਰੇ ਵਿੱਚ ਇੱਕ ਟੈਕਨੀਕਲ ਪਰੋਬਲਮ ਜਿਹੜੀ ਹੈਗੀ ਹੈ ਉਹ ਹੈ ਕਿ ਮੈਨੂੰ ਇਹ ਕਿਹਾ ਗਿਆ ਕਿ ਜਦੋਂ ਮੈਂ ਗਾਉਂਦੀ ਹਾਂ ਤਾਂ ਮੇਰੀ ਜਿਹੜੀ ਜੀਭ ਹੈ ਥੋੜ੍ਹੀ ਉਹ ਬਾਹਰ ਨਿਕਲਦੀ ਹੈ ਜਿਹੜੀ ਕਿ ਕਿਸੇ ਸਿੰਗਿੰਗ ਕੋਮਪੀਟੀਸ਼ਨ ਦੇ ਵਿੱਚ ਨਹੀਂ ਚਾਹੀਦੀ ਹੁੰਦੀ ਉਹ ਚੀਜ਼ ਤਾਂ ਇਸ ਕਰਕੇ ਮੈਨੂੰ ਇੱਕ ਕੋਮਪੀਟੀਸ਼ਨ ਤੋਂ ਵਿੱਚ ਮਤਲਬ ਲਿਆ ਨਹੀਂ ਗਿਆ ਤਾਂ ਮੈਂ ਬਹੁਤ ਜ਼ਿਆਦਾ ਨਿਰਾਸ਼ ਹੋਈ ਸੀ ਇਸ ਚੀਜ਼ ਨੂੰ ਲੈ ਕੇ ਲੇਕਿਨ ਜਦੋਂ ਬੀ ਐਡ ਦੇ ਵਿੱਚ ਜਾ ਕੇ ਮੈਨੂੰ ਇਹ ਮਿਲਿਆ ਚਾਨਸ ਦੁਬਾਰਾ ਤਾਂ ਮੈਂ ਬਹੁਤ ਖੁਸ਼ ਹੋਈ